ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਮੈਂ ਬਹੁਤ ਹੀ ਤਾਜਾ ਅਤੇ ਹਲਕਾ ਮਹਿਸੂਸ ਕਰਦੀ ਹਾਂ ਜਿਸ ਦਿਨ ਵੀ ਮੈਂ ਭੰਗੜਾ ਜਾਂ ਐਰੋਬਿਕਸ ਕਰ ਲਵਾਂ ਮੇਰੇ ਸਰੀਰ ਵਿੱਚ ਬਹੁਤ ਹੀ ਸਪੁਰਤੀ ਆ ਜਾਂਦੀ ਹੈ ਭੰਗੜਾ ਐਰੋਬਿਕਸ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਇਹ ਸਾਨੂੰ ਅੱਛਾ ਦਿਖਣ ਵਿੱਚ ਵੀ ਸਹ ਸਹਾਇਤਾ ਕਰਦਾ ਹੈ ਇਹ ਦਿੱਖ ਅਤੇ ਸਰੀਰ ਦੀ ਸੁੰਦਰਤਾ ਵਿੱਚ ਵੀ ਸੁਧਾਰ ਕਰਦਾ ਹੈ ਜਿਵੇਂ ਕਿ ਲਚਕੀਲਾਪਨ ਅਤੇ ਬੈਲੇਂਸ ਵਿੱਚ ਵਾਧਾ ਜੇ ਆਪਾਂ ਮਾਨਸਿਕ ਦੀ ਗੱਲ ਕਰੀਏ ਤਾਂ ਭੰਗੜਾ ਐਰੋਬਿਕਸ ਨਾਲ ਮਨ ਵੀ ਖੁਸ਼ ਹੋ ਜਾਂਦਾ ਹੈ ਕਿਉਂਕਿ ਇਹ ਜਿਆਦਾ ਮਜੇਦਾਰ ਐਕਟੀਵਿਟੀ ਹੈ ਇਸ ਨਾਲ ਸਿੱਧਾ ਤੁਹਾਡੀ ਮੋਟਰ ਅਤੇ ਮਨੋ ਵਿਗਿਆਨ ਹਲਚਲ ਹੁੰਦੀ ਹੈ ਜਿਵੇਂ ਕੀ ਕੋਈ ਵੀ ਦਬਾਵ ਅਤੇ ਚਿੰਤਾ ਘਟਾਉਣ ਵਿੱਚ ਇਹ ਬਹੁਤ ਜਿਆਦਾ ਮਦਦ ਕਰਦਾ ਹੈ ਅਗਰ ਤੁਸੀਂ ਕਿਸੀ ਵੀ ਤਰ੍ਹਾਂ ਦੇ ਦਬਾਵ ਵਿੱਚ ਹੋ ਤਾਂ ਇਹਦੇ ਨਾਲ ਤੁਹਾਡਾ ਧਿਆਨ ਦੂਜੇ ਪਾਸੇ ਨੂੰ ਪੈ ਜਾਂਦਾ ਹੈ ਭੰਗੜਾ ਕਰਨ ਨਾਲ ਪੂਰਾ ਮਨ ਤਾਜਗੀ ਨਾਲ ਭਰ ਜਾਂਦਾ ਹੈ ਅਤੇ ਇਹ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਕਰਦਾ ਹੈ ਇਸ ਨਾਲ ਸਰੀਰ ਅਤੇ ਮਨ ਦੀ ਬਹੁਤ ਹੀ ਵਧੀ ਹੁੰਦੀ ਹੈ